ਹਾਂਜੀ ਸਾਨੂੰ ਲੱਗਦਾ ਹੈ ਕਿ ਸਕੂਲਾਂ ਵਿੱਚ ਵਧੇਰੇ ਕਿੱਤਾ ਮੁਖੀ ਸਿੱਖਿਆ ਦੇ ਨਾਲ ਨਾਲ ਤਰਖਾਣ ਪਲੰਬਰਿੰਗ ਸਿਲਾਈ ਪੋਲਟਰੀ ਅਤੇ ਪਸ਼ੂ ਪਾਲਣ ਨੂੰ ਵੀ ਸਿਖਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਨਾਲ ਪੜ੍ਹਾਈ ਸਿੱਖਿਆ ਦਾ ਹੋਣਾ ਤਾਂ ਬਹੁਤ ਜ਼ਰੂਰੀ ਹੈ ਬਟ ਸਿੱਖਿਆ ਤੋਂ ਬਾਅਦ ਵੀ ਹੱਥੀਂ ਹੁਨਰ ਹੋਣਾ ਵੀ ਜ਼ਰੂਰੀ ਹੈ ਜਿਸ ਦੇ ਨਾਲ ਬੱਚੇ ਪੜ੍ਹਾਈ ਤੋਂ ਬਾਅਦ ਹੱਥੀਂ ਹੁਨਰ ਹੋਣ ਤੋਂ ਬਾਅਦ ਆਪਣਾ ਘਰ ਦਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ